ਮੈਂ ਪੰਜਾਬ ਰਾਜ ਦਾ ਰਹਿਣ ਵਾਲਾ ਜੀ ਇੱਥੇ ਹਰ ਧਰਮ ਦਾ ਹਰ ਧਰਮ ਦਾ ਬੰਦਾ ਵਸਦਾ ਹੈ ਖਾਸ ਤੌਰ 'ਤੇ ਇੱਥੇ ਸਿੱਖ ਧਰਮ ਹੈ ਉਹਦੇ ਨਾਲ ਨਾਲ ਹਿੰਦੂ ਧਰਮ ਵੀ ਵੱਡੀ ਗਿਣਤੀ ਦੇ ਵਿੱਚ ਹੈ ਉਸ ਤੋਂ ਬਾਅਦ ਮੁਸਲਿਮ ਸਮਾਜ ਹੈ ਉਹ ਤੋਂ ਬਾਅਦ ਕਰਿਸ਼ਚਨ ਵੀ ਇੱਥੇ ਕਾਫ਼ੀ ਗਿਣਤੀ ਦੇ ਵਿੱਚ ਹੈਗੇ ਨੇ ਇੱਥੇ ਹਰ ਧਰਮ ਦਾ ਸਤਿਕਾਰ ਕੀਤਾ ਜਾਂਦਾ ਹੈ ਇੱਕ ਜਿਵੇਂ ਕਿ ਮੈਂ ਮੁਸਲਿਮ ਧਰਮ ਨਾਲ ਬਿਲੌਂਗ ਕਰਦਾ ਹਾਂ ਜਿੱਥੇ ਅਸੀਂ ਆਪਣੇ ਇਮਾਮਾਂ ਦਾ ਮੌਲਵੀਆਂ ਦਾ ਸਾਡੇ ਧਾਰਮਿਕ ਆਗੂਆਂ ਦਾ ਅਸੀਂ ਸਤਿਕਾਰ ਕਰਦੇ ਹਾਂ ਅਸੀਂ ਉੱਥ ਉਸ ਦੇ ਨਾਲ ਨਾਲ ਹਿੰਦੂ ਧਰਮ ਦੇ ਪੰਡਤਾਂ ਦਾ ਅਤੇ ਸ ਸਿੱਖ ਧਰਮ ਦੇ ਗ੍ਰੰਥੀਆਂ ਦਾ ਵੀ ਪੂਰਾ ਸਤਿਕਾਰ ਕਰਦੇ ਹਾਂ ਉਹਨਾਂ ਨੂੰ ਪੂਰੀ ਰਿਸਪੈਕਟ ਦਿੰਦੇ ਹਾਂ ਸਿੱਖ ਧਰਮ ਦੇ ਗੁਰੂ ਸਾਹਿਬਾਨ ਦੀ ਪੂਰੀ ਰਿਸਪੈਕਟ ਕੀਤੀ ਜਾਂਦੀ ਹੈ ਪੰਜਾਬ ਵਿੱਚ ਕੋਈ ਭੇਦ ਭਾਵ ਨਹੀਂ ਕੀਤਾ ਜਾਂਦਾ ਧਰਮ ਧਾਰਮਿਕ ਤੌਰ 'ਤੇ ਹਰ ਬੰਦਾ ਇੱਕ ਦੂਜੇ ਨੂੰ ਰਿਸਪੈਕਟ ਦਿੰਦਾ ਜਿਹਦੇ ਕਰਕੇ ਪੰਜਾਬ ਦਾ ਜਿਹੜਾ ਮਾਹੌਲ ਹੈ ਉਹ ਬਹੁਤ ਹੀ ਵਧੀਆ ਅਤੇ ਭਾਈਚਾਰੇ ਵਾਲਾ ਹੈ ਸਾਡਾ ਧਰਮ ਮੈਂ ਇਸਲਾਮ ਧਰਮ ਨਾਲ ਬਿਲੌਂਗ ਕਰਦਾ ਇਸਲਾਮ ਧਰਮ ਦੇ ਵਿੱਚ ਇਹੀ ਸਿਖਾਇਆ ਜਾਂਦਾ ਹੈ ਕਿ ਹਰ ਇੱਕ ਦਾ ਸਤਿਕਾਰ ਕੀਤਾ ਜਾਵੇ ਹਰ ਇੱਕ ਦੇ ਨਾਲ ਪਿਆਰ ਮੁਹੱਬਤ ਦੇ ਨਾਲ ਰਿਹਾ ਜਾਵੇ ਖਾਸ ਤੌਰ 'ਤੇ ਗੁਆਂਢੀ ਦੇ ਸੰਬੰਧ ਵਿੱਚ ਗੁਆਂਢੀ ਦਾ ਪੂਰਾ ਧਿਆਨ ਰੱਖਣਾ ਇਹ ਨਹੀਂ ਹੈ ਕਿ ਆਪ ਹੀ ਪੇਟ ਭਰ ਕੇ ਖਾਣਾ ਹੈ ਆਪਣੇ ਗੁਆਂਢ ਆਂਢ ਗੁਆਂਢ 'ਚ ਵੀ ਦੇਖਣਾ ਹੈ ਕਿ ਕੋਈ ਰਾਤ ਵੇਲੇ ਭੁੱਖਾ ਨਾ ਸੌ ਜਾਵੇ ਭਾਵੇਂ ਉਹ ਕਿਸੇ ਵੀ ਧਰਮ ਦਾ ਹੋਵੇ ਸ ਸਭ ਦਾ ਹੀ ਧਿਆਨ ਰੱਖਣਾ ਸਭ ਦਾ ਹੀ ਸਤਿਕਾਰ ਕਰਨਾ ਹੈ